ਸਾਡੇ ਖੇਤਰ ਦੇ ਵਿੱਚ ਬਹੁਤ ਸਾਰੇ ਕੁਦਰਤੀ ਸਰੋਤ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਜੋ ਆਮ ਆਪਾਂ ਨੂੰ ਮਿਲ ਜਾਂਦੇ ਨੇ ਅਤੇ ਜੇ ਮੇਨ ਗੱਲ ਕਰੀਏ ਤਾਂ ਲੱਕੜ ਦੀ ਗੱਲ ਕਰਦੇ ਆ ਤਾਂ ਇਹਦੇ ਲਈ ਸਪੈਸ਼ਲ ਪੋਪੂਲਰ ਦੇ ਬੂਟੇ ਵੀ ਲਗਾਏ ਜਾਂਦੇ ਆ ਜੋ ਆਪਾਂ ਨੂੰ ਲੱਕੜ ਪ੍ਰਦਾਨ ਕਰਦੇ ਨੇ ਤੇ ਇਹਨਾਂ ਨੂੰ ਲੋਕ ਵੇਚਦੇ ਵੀ ਨੇ ਮਤਲਬ ਇਹ ਇੱਕ ਬਿਜ਼ਨਸ ਬਣਿਆ ਹੋਇਆ ਹੈ ਕਿ ਲੋਕ ਦੋ ਤੋਂ ਤਿੰਨ ਸਾਲ ਲਈ ਪਾਪੂਲਰਾਂ ਦੀ ਖੇਤੀ ਆਪਣੇ ਖੇਤ ਦੇ ਵਿੱਚ ਕਰਦੇ ਨੇ ਅਤੇ ਉਹਨਾਂ ਨੂੰ ਬਾਅਦ ਵਿੱਚ ਵੇਚ ਦਿੰਦੇ ਨੇ ਅਤੇ ਲੱਕੜ ਤੋਂ ਬਹੁਤ ਸਾਰਾ ਸਮਾਨ ਬਣਾਇਆ ਜਾਂਦਾ ਹੈ ਜਿਵੇਂ ਦਰਵਾਜ਼ੇ ਹੋ ਗਏ ਸੋਫਾ ਸੈੱਟ ਹੋ ਗਿਆ ਅਤੇ ਹੋਰ ਵੀ ਬਹੁਤ ਸਾਰੀਆਂ ਲੱਕੜ ਦੀਆਂ ਚੀਜ਼ਾਂ ਘਰੇ ਬਣਾਈਆਂ ਜਾਂਦੀਆਂ ਨੇ ਅਤੇ ਜੋ ਆਮ ਵਰਤੋਂ ਵਿੱਚ ਆਉਂਦੀਆਂ ਨੇ ਅਤੇ ਇਹ ਤੋਂ ਇਲਾਵਾ ਪਾਣੀ ਆਪਣਾ ਕੁਦਰਤੀ ਸਰੋਤ ਆ ਜੋ ਕਿ ਬਿਜਲੀ ਬਣਾਉਣ ਲਈ ਵਰਤਿਆ ਜਾਂਦਾ ਆ ਅਤੇ ਇਹ ਤੋਂ ਇਲਾਵਾ ਕੋਲਾ ਕੋਲੇ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਆ ਅਤੇ ਇਸ ਤੋਂ ਇਲਾਵਾ ਆਪਾਂ ਨੂੰ ਇੱਕ ਹੋਰ ਕੁਦਰਤੀ ਸਰੋਤ ਰੇਤਾ ਮਿਲ ਜਾਂਦਾ ਆਪਣੀ ਧਰਤੀ ਰੇਤਲੀ ਹੁੰਦੀ ਆ ਉਹ ਜਿਹੜੀ ਰੇਤਾ ਆ ਆਪਾਂ ਨੂੰ ਘਰ ਬਣਾਉਣ ਦੇ ਵਿੱਚ ਸਮਿੰਟ ਦੇ ਨਾਲ ਯੂਜ਼ ਹੁੰਦਾ ਆ ਅਤੇ ਉਹਦੇ ਨਾਲ ਕੀ ਆ ਆਪਣੇ ਘਰਾਂ ਦੀ ਜਿਹੜੀ ਬਣਤਰ ਆ ਉਹ ਬਹੁਤ ਜ਼ਿਆਦਾ ਵਧੀਆ ਬਣਦੀ ਆ ਸੋ ਇਸ ਚੀਜ਼ ਨੂੰ ਇਮਪਰੂਵਮੈਂਟ ਕਰਦਾ ਅਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੁਦਰਤੀ ਸਰੋਤ ਆਪਾਂ ਨੂੰ ਮਿਲ ਜਾਣਗੇ ਬਟ ਮੇਨਲੀ ਜੇ ਆਪਾਂ ਗੱਲ ਕਰੀਏ ਤਾਂ ਲੱਕੜ ਪਾਣੀ ਕੋਲਾ ਰੇਤਾ ਆਦਿ ਜਿਹੜੇ ਸਰੋਤ ਨੇ ਆਪਣੇ ਕੁਦਰਤੀ ਆ ਆਪਣੇ ਨੇੜਲੇ ਥਾਵਾਂ 'ਤੇ ਪਾਏ ਜਾਂਦੇ ਨੇ